ਭਾਅ ਜੀ ਤੁਸੀਂ ਫਲਿੱਪਕਾਰਟ ਤੋਂ ਗੱਲ ਕਰ ਰਹੇ ਹੋ ਮੈਂ ਇੱਕ ਫੀਡਬੈਕ ਦੇਣਾ ਸੀ ਆਪਣਾ ਹਾਲ ਹੀ 'ਚ ਮੈਂ ਇੱਕ ਪ੍ਰੋਡਕਟ ਲਿਆ ਸੀ ਜੀ ਈ ਬੁੱਕ ਸੀ ਉਹ ਉਹ ਬੁੱਕ ਦਾ ਨਾਂ ਸੀ ਡੂ ਐਪੀਸ ਸ਼ਿੱਟ ਅੰਕੁਰਵਾਰੀਕੋ ਦੀ ਬੁੱਕ ਸੀ ਅਤੇ ਤੁਸੀਂ ਬੜਾ ਹੀ ਬੇਕਾਰ ਜਿਹਾ ਪ੍ਰੋਡਕਟ ਮੈਨੂੰ ਦਿੱਤਾ ਜੀ ਤੁਹਾਨੂੰ ਪਤਾ ਵੀ ਹੈ ਕਿ ਜਿਹੜੀ ਬੁੱਕ ਤੁਸੀਂ ਮੈਨੂੰ ਵੀਹ ਡੋਲਰ 'ਚ ਦਿੱਤੀ ਹੈ ਉਹ ਐਮਾਜ਼ੋਨ ਮੈਨੂੰ ਦਸ ਡੋਲਰ 'ਚ ਦੇ ਰਿਹਾ ਹੈ ਤੇ ਜਿਹੜਾ ਡਿਲੀਵਰੀ ਟਾਈਮ ਸੀ ਉਹ ਘੱਟੋ ਘੱਟ ਇੱਕ ਘੰਟੇ 'ਚ ਮੇਰੀ ਐਪ 'ਚ ਦਿਖਣਾ ਸ਼ੁਰੂ ਹੋ ਜਾਣਾ ਚਾਹੀਦਾ ਸੀ ਜੋ ਕਿ ਇਦਾਂ ਹੋਇਆ ਨਹੀਂ ਮੈਨੂੰ ਚਾਰ ਘੰਟੇ ਲੱਗ ਗਏ ਚਾਰ ਘੰਟੇ ਬਾਅਦ ਤੁਹਾਡੀ ਬੁੱਕ ਜਿਹੜੀ ਹੈ ਮੈਨੂੰ ਆਪਣੀ ਈ ਬੁੱਕ ਪਲੈਟਫੌਰਮ 'ਚ ਦਿਖੀ ਹੈ ਇਹ ਕੋਈ ਵਧੀਆ ਗੱਲ ਨਹੀਂ ਹੈ ਤੁਹਾਡਾ ਪ੍ਰੋਡਕਟ ਐਕਸਪੀਰੀਅਸ ਜਿਹੜਾ ਸੀ ਫਲਿੱਪਕਾਰਟ ਨਾਲ ਮੇਰਾ ਕੋਈ ਖਾਸ ਵਧੀਆ ਨਹੀਂ ਰਿਹਾ ਮੈਂ ਆਪਣੇ ਕਿਸੇ ਵੀ ਮਿੱਤਰ ਨੂੰ ਇਹ ਸੁਜੈਸਟ ਨਹੀਂ ਕਰਨ ਲੱਗਾ ਕਿ ਕੋਈ ਵੀ ਆਪਣੀ ਈ ਬੁੱਕ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਆਪਣਾ ਪ੍ਰੋਡਕਟ ਹੈ ਫਲਿੱਪਕਾਰਟ ਤੋਂ ਲਓ ਜਿਹੜੀ ਡਿਲੀਵਰੀ ਹੈ ਉਹਨੂੰ ਹੋਰ ਵੀ ਕੀਤਾ ਜਾ ਸਕਦਾ ਹੈ ਵਧੀਆ ਕਿਉਂਕਿ ਔਨਲਾਈਨ ਹੀ ਈ ਬੁੱਕ ਹੀ ਲਈ ਸੀ ਜੀ ਮੈਂ ਕਿਹੜਾ ਅਸਲੀ ਫਿਜ਼ੀਕਲ ਕੋਪੀ ਮੰਗਾਈ ਸੀ ਕੀ ਉਹ ਮੇਰੇ ਘਰ ਆਉਣੀ ਸੀ ਘੱਟੋ ਘੱਟ ਤੁਸੀਂ ਇਹਨੂੰ ਪੰਦਰਾਂ ਮਿੰਟ 'ਚ ਮੈਨੂੰ ਡਿਲੀਵਰ ਕਰ ਦਿੰਦੇ ਮੈ ਇਹ ਗਿਫਟ ਕਰਨਾ ਸੀ ਕਿਸੇ ਦਾ ਬਡੇ 'ਚ ਮੇਰਾ ਸਾਰਾ ਐਕਸਪੀਰੀਅਸ ਖਰਾਬ ਕਰ ਦਿੱਤਾ ਜੋ ਕੀ ਵਧੀਆ ਗੱਲ ਨੀ ਹੈ ਅੱਗੇ ਤੋਂ ਮੈਂ ਕਿਸੇ ਨੂੰ ਵੀ ਨਹੀਂ ਕਹਾਂਗਾ ਕੀ ਫਲਿੱਪਕਾਰਟ ਤੋਂ ਕੁਝ ਮੰਗਾਓ